ਦੇਖਿਆ ਜਾਵੇ ਤਾਂ ਅੱਜ ਦੀ ਸਦੀ ਵਿੱਚ ਮੋਬਾਇਲ ਫੋਨ ਇੱਕ ਤਰ੍ਹਾਂ ਨਾਲ ਬਹੁਤ ਹੀ ਜ਼ਿਆਦਾ ਜ਼ਰੂਰੀ ਚੀਜ਼ ਬਣ ਗਿਆ ਹੈ ਮੋਬਾਇਲ ਫੋਨ ਜਿਉਂ ਜਿਉਂ ਸਮਾਂ ਵੱਧਦਾ ਜਾ ਰਿਹਾ ਹੈ ਤਾਂ ਮੋਬਾਇਲ ਫੋਨ ਵੀ ਆਪਣੇ ਆਪ 'ਚ ਵਿਕਸਿਤ ਹੁੰਦਾ ਜਾ ਰਿਹਾ ਹੈ ਕੰਪਨੀਆਂ ਇੱਕ 'ਤੇ ਇੱਕ ਟਕਨੋਲਜੀ ਮੋਬਾਇਲ ਦੇ ਵਿੱਚ ਪਾ ਰਹੀਆਂ ਹਨ ਮੋਬਾਇਲ ਫੋਨ ਦੇ ਨਾਲ਼ ਬਹੁਤ ਸਾਰੀ ਮਦਦ ਹੁੰਦੀ ਹੈ ਬੱਚਿਆਂ ਨੂੰ ਪੜ੍ਹਨ ਵਿੱਚ ਵੀ ਮਦਦ ਹੁੰਦੀ ਹੈ ਕਿਵੇਂ ਕਿਤੇ ਵੀ ਕਮਿਊਨੀਕੇਸ਼ਨ ਕਰਨੀ ਹੈ ਆਪਾਂ ਕੁਛ ਵੀ ਅੱਗੇ ਕਿਸੇ ਨੂੰ ਭੇਜਣਾ ਕੋਈ ਇਨਫੋਮੇਸ਼ਨ ਲੈਣੀ ਤਾਂ ਮੋਬਾਇਲ ਫੋਨ ਤੋਂ ਆਪਾਂ ਪ੍ਰਾਪਤ ਕਰ ਸਕਦੇ ਹਾਂ ਮੋਬਾਇਲ ਫੋਨ 'ਤੇ ਲੋਕ ਆਪਣੇ ਟੂਰਿਜ਼ਮ ਟੁਰਿਅਮ ਟੂਰਿਜ਼ਮ ਵਿੱਚ ਘੁੰਮਦੇ ਅਤੇ ਆਪਣੀਆਂ ਫੋਟੋਆਂ ਖਿੱਚਦੇ ਜਿਸ ਨਾਲ ਆਪਣੀ ਯਾਦਗਾਰ ਰੱਖਦੇ ਹਨ ਵੀ ਅ ਅਸੀਂ ਕਿੱਥੇ ਘੁੰਮੇ ਸੀ ਕਿੱਦਾਂ ਗਏ ਸੀ ਇੱਦਾਂ ਵੀ ਬਹੁਤ ਮਦਦ ਕਰਦਾ ਹੈ ਹੁਣ ਜਿਵੇਂ ਮੰਨ ਲਉ ਕਿਸੇ ਵੀ ਦੇਸ਼ ਦੇ ਕੋਨੇ ਵਿੱਚ ਬੈਠੇ ਕਿਤੇ ਵੀ ਬਾਹਰ ਬੈਠੇ ਆ ਆਪਣੇ ਰਿਸ਼ਤੇਦਾਰ ਨਾਲ਼ ਕਿਸੇ ਨਾਲ਼ ਵੀ ਸੰਪਰਕ ਕਰਨਾ ਆਪਾਂ ਵੀਡੀਓ ਕਾਲ ਦੇ ਰਾਹੀਂ ਇਮੋ ਦੇ ਰਾਹੀਂ ਕਿਸੇ ਵੀ ਤਰੀਕੇ ਨਾਲ਼ ਅਸੀਂ ਇੱਕ ਦੂਜੇ ਨੂੰ ਦੇਖ ਸਕਦੇ ਹਾਂ ਇਸ ਦੇ ਨਾਲ਼ ਸਾਨੂੰ ਲੱਗਦਾ ਵੀ ਨਾ ਅਸੀਂ ਇੱਕ ਦੂਜੇ ਤੋਂ ਦੂਰ ਨਹੀਂ ਹਾਂ ਅਸੀਂ ਸਾ ਇੱਕ ਦੂਜੇ ਦੇ ਸਾਹਮਣੇ ਬੈਠੇ ਹਾਂ ਦੇਖਿਆ ਅੱਜ ਕੱਲ੍ਹ ਦੇ ਸਮੇਂ ਵਿੱਚ ਨਾ ਨੈੱਟਵਰਕ ਵਲਡ ਵਰਲਡਵਾਈਡ ਵੱਧਦਾ ਹੀ ਜਾ ਰਿਹਾ ਹੈ ਅਤੇ ਮੋਬਾਇਲ ਵੀ ਮੋਬਾਇਲ ਦਾ ਯੂਜ਼ ਵੀ ਵੱਧਦਾ ਜਾ ਰਿਹਾ ਬੱਚਿਆਂ ਲਈ ਵੀ ਬੁਢਾਪੇ ਕਿਸੇ ਵੀ ਲਈ ਹੈ ਹਰ ਹਰ ਇੱਕ ਪੀੜ੍ਹੀ ਲਈ ਹਰ ਇੱਕ ਨੌਜਵਾਨ ਬਜ਼ੁਰਗ ਬੱਚੇ ਬੁਢਾਪੇ ਲਈ ਬਹੁਤ ਜ਼ਰੂਰੀ ਹੋ ਗਿਆ ਹੈ ਇਸ ਦਾ ਜ਼ ਇਸ ਦੀ ਜ਼ਰੂਰਤ ਵੀ ਇਸੇ ਤਰ੍ਹਾਂ ਅੱਗੇ ਅੱਗੇ ਵੱਧਦੀ ਜਾਂਦੀ ਹੈ ਅਤੇ ਇਹਦਾ ਵਿਕਾਸ ਵੀ ਵੱਧਦਾ ਹੀ ਜਾ ਰਿਹਾ ਹੈ